ਭਾਰਤ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਦਾ ਆਪਣਾ ਆਪਣਾ ਪਕਵਾਨ ਹੈ ਜੋ ਕਿ ਉਹਨਾਂ ਦੇ ਇਲਾਕੇ ਅਤੇ ਸਮੂਹ ਅਨੁਸਾਰ ਬਹੁਤ ਜ਼ਿਆਦਾ ਪ੍ਰਸਿੱਧ ਹੈ ਅਤੇ ਇਸੇ ਤਰ੍ਹਾਂ ਪੰਜਾਬ ਵੀ ਇੱਕ ਬਹੁਤ ਵੱਡਾ ਰਾਜ ਹੈ ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਖਾਣੇ ਬਹੁਤ ਜ਼ਿਆਦਾ ਪ੍ਰਸਿੱਧ ਹਨ ਜਿਵੇਂ ਕਿ ਮੌਸਮ ਦੇ ਹਿਸਾਬ ਨਾਲ ਇੱਥੇ ਦਾ ਖਾਣ ਪਕਵਾਨ ਬਦਲਦਾ ਰਹਿੰਦਾ ਹੈ ਜਿਵੇਂ ਕਿ ਸਰਦੀਆਂ ਦੇ ਵਿੱਚ ਪੰਜਾਬ ਦੇ ਵਿੱਚ ਅਕਸਰ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਮੂਲੀ ਦੇ ਪਰਾਂਠੇ ਗੋਭੀ ਦੇ ਪਰਾਂਠੇ ਗੋਭੀ ਦੀ ਸਬਜ਼ੀ ਗਾਜਰਾਂ ਦੀ ਸਬਜ਼ੀ ਅਤੇ ਆਮ ਕਈ ਪਕਵਾਨ ਬਣਦੇ ਹਨ ਜੋ ਕਿ ਇੱਥੇ ਦੇ ਕਾਫੀ ਪ੍ਰਸਿੱਧ ਹਨ ਪਰ ਸਭ ਤੋਂ ਵੱਧ ਪੰਜਾਬ ਦਾ ਖਾਣਾ ਸਰ ਸਰਦੀਆਂ ਦੇ ਵਿੱਚ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਪ੍ਰਸਿੱਧ ਹੈ ਕਿਉਂਕਿ ਇਹ ਆਸਾਨੀ ਨਾਲ ਸਰਦੀਆਂ ਦੇ ਵਿੱਚ ਮਿਲ ਜਾਂਦਾ ਹੈ ਅਤੇ ਇਹਨੂੰ ਬਣਾਉਣ ਦਾ ਤਰੀਕਾ ਬਹੁਤ ਜ਼ਿਆਦਾ ਆਸਾਨ ਹੈ ਅਤੇ ਇਹਦੇ ਵਿੱਚ ਜੋ ਮਸਾਲੇ 'ਤੇ ਬਾਕੀ ਸਬਜ਼ੀਆਂ ਲਸਣ ਪਿਆਜ ਵਗੈਰਾ ਵਰਤਿਆ ਜਾਂਦਾ ਹੈ ਉਹ ਸਿਹਤ ਲਈ ਕਾਫੀ ਚੰਗਾ ਹੈ ਇਹਦੇ ਵਿੱਚ ਸਭ ਤੋਂ ਪ੍ਰਸਿੱਧ ਜਿਹੜਾ ਮਸਾਲਾ ਜਾਂ ਕੋਈ ਵੀ ਆਪਣਾ ਪਿਆਜ ਲਸਣ ਵਗੈਰਾ ਪੈਂਦੇ ਇਹ ਸਾਡੀ ਸਿਹਤ ਲਈ ਕਾਫੀ ਚੰਗਾ ਹੁੰਦਾ ਕਿਉਂਕਿ ਸਰਦੀਆਂ ਦੇ ਵਿੱਚ ਸਾਨੂੰ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਕਿ ਸਾਡੇ ਸਰੀਰ ਨੂੰ ਗਰਮਾਹਟ ਦੇਣ ਇਸੇ ਤਰੀਕੇ ਨਾਲ ਸਾਡੇ ਹੋਰ ਗਾਜਰਾਂ ਗਾਜਰ ਅਤੇ ਆਲੂ ਦੀ ਸਬਜ਼ੀ ਵੀ ਕਾਫੀ ਜ਼ਿਆਦਾ ਪ੍ਰਸਿੱਧ ਹੈ ਸਰਦੀਆਂ ਦੇ ਵਿੱਚ ਕਿਉਂਕਿ ਸਰਦੀਆਂ ਦੀ ਸਭ ਤੋਂ ਵਧੀਆ ਖੁਰਾਕ ਮੰਨੀ ਗਈ ਹੈ ਇਹਦੇ ਵਿੱਚ ਅਸੀਂ ਕਾਫੀ ਮਸਾਲਿਆਂ ਦਾ ਯੂਜ਼ ਕਰਦੇ ਹਾਂ ਜਿਵੇਂ ਗਰਮ ਮਸਾਲਾ ਕਸੂਰੀ ਮੇਥੀ ਸੁੱਖੇ ਮੇਥੇ ਅਤੇ ਲਸਣ ਪਿਆਜ ਟਮਾਟਰ ਅਦਰਕ ਧਨੀਆ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਪਕਵਾਨ ਨੂੰ ਬਣਾਉਂਦੇ ਹਾਂ ਅਤੇ ਇੱਥੋਂ ਦਾ ਸਵੇਰ ਦਾ ਸਭ ਤੋਂ ਜ਼ਿਆਦਾ ਖਾਣਾ ਪ੍ਰਸਿੱਧ ਹੈ ਪਰਾਂਠੇ ਪੰਜਾਬ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪਰਾਂਠੇ ਬਣਦੇ ਹਨ ਜਿਵੇਂ ਕਿ ਗੋਭੀ ਦੇ ਪਰਾਂਠੇ ਆਲੂ ਦੇ ਪਰਾਂਠੇ ਮੂਲੀ ਦੇ ਪਰਾਂਠੇ ਨਮਕ ਦੇ ਪਰਾਂਠੇ ਅਤੇ ਬਾਕੀ ਹੋਰ ਤਰ੍ਹਾਂ ਦੇ ਪਰਾਂਠੇ ਜਿਵੇਂ ਕਿ ਪਿਆਜ਼ ਦੇ ਅਤੇ ਹਰੇਕ ਪਰਾਂਠੇ ਨੂੰ ਬਣਾਉਣ ਦਾ ਆਪਣਾ ਅਲੱਗ ਅਲੱਗ ਢੰਗ ਹੈ ਜਿਵੇਂ ਕਿ ਗੋਭੀ ਦੇ ਪਰਾਂਠੇ ਨੂੰ ਬਣਾਉਣ ਬਣਾਉਣ ਲੱਗੇ ਅਸੀਂ ਗੋਭੀ ਨੂੰ ਚੀਰ ਕੇ ਉਹਦੇ ਵਿੱਚ ਕਾਫੀ ਨੂਨ ਮਿਰਚ ਨਮਕ ਮਿਰਚ ਹਲਦੀ ਪਿਆਜ ਮਸਾਲੇ ਵਗੈਰਾ ਵਿੱਚ ਮਿਲਾ ਕੇ ਉਹਨਾਂ ਦਾ ਇੱਕ ਪੇਸਟ ਬਣਾ ਕੇ ਪਰਾਂਠਾ ਬਣਾਉਂਦੇ ਹਾਂ ਜੋ ਕਿ ਸਿਹਤ ਲਈ ਕਾਫੀ ਚੰਗਾ ਹੁੰਦਾ ਹੈ ਅਤੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ